ਰਸਮੀ ਕਾਰਵਾਈਆਂ ਦਾ ਵਰਣਨ ਮਤਲਬ ਜਿੱਦਾ ਨਵਾਂ ਕਾਰੋਬਾਰ ਸ਼ੁਰੂ ਕਰਨ ਵੇਲੇ ਤਾਂ ਦੇਖੋ ਜਦੋਂ ਅਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਇੱਕ ਅਸੀਂ ਮਤਲਬ ਰੱਬ ਦਾ ਨਾਂ ਲੈਂਦੇ ਹਾਂ ਹੈ ਨਾ ਇੱਕ ਪਾਠ ਕਰਵਾਉਂਦੇ ਹਾਂ ਘਰ ਦੇ ਵਿੱਚ ਅਤੇ ਜਾਂ ਕਿਤੇ ਦੁਕਾਨ ਦੇ ਵਿੱਚ ਜੋ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਹੈ ਨਾ ਅਤੇ ਉਹਨੂੰ ਸ਼ੁਰੂ ਕਰਨ ਤੋਂ ਬਾਅਦ ਫਿਰ ਅਸੀਂ ਵੀ ਮੈਂ ਨਹੀਂ ਸਮਝਦੀ ਕੀ ਕਹਿੰਦੇ ਕੀ ਕਾਰੋਬਾਰ ਸ਼ੁਰੂ ਕਰਨ ਲਈ ਇੱਕ ਵੱਡੀ ਪੂੰਜੀ ਦੀ ਲੋੜ ਹੈ ਨਹੀਂ ਕੋਈ ਇੰਨੀ ਖਾਸ ਲੋੜ ਨਹੀਂ ਹੁੰਦੀ ਕਿਉਂਕਿ ਹੁਣ ਅੱਜ ਕੱਲ੍ਹ ਕਈ ਕੰਮ ਇਹੋ ਜਿਹੇ ਆ ਗਏ ਆ ਕਿ ਤੁਸੀਂ ਆਪਣੇ ਕੋਲੋਂ ਕੋਈ ਇਨਵੈਸਟਮੈਂਟ ਕਰਨੀ ਨਹੀਂ ਹੈ ਤੁਸੀਂ ਸਿਰਫ ਕੰਮ ਸ਼ੁਰੂ ਕਰਨਾ ਆ ਇਨਵੈਸਟਮੈਂਟ ਜਿਹੜੀ ਹੈ ਉਹ ਦੂਸਰੇ ਤੁਸੀਂ ਕਲਾਇੰਟ ਦੀ ਕਰਵਾਉਣੀ ਹੈ ਅਤੇ ਤੁਸੀਂ ਆਪਣਾ ਅੱਛੀ ਅਰਨਿੰਗ ਉਹਦੇ ਵਿੱਚੋਂ ਹੀ ਕਰ ਲੈਂਦੇ ਹੈ ਜਿੱਦਾਂ ਕਮਿਸ਼ਨ ਬੇਸ ਕੰਮ ਹੁੰਦੇ ਆ ਹੈ ਨਾ ਜਿੱਦਾਂ ਹੈ ਬੀਮਾ ਕੰਪਨੀਆਂ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਅਤੇ ਫਿਰ ਉਹ ਨਾ ਤੁਹਾਨੂੰ ਉੱਥੇ ਆਫਿਸ ਦੀ ਲੋੜ ਪੈਂਦੀ ਹੈ ਨਾ ਤੁਹਾਨੂੰ ਸਟਾਫ ਦੀ ਲੋੜ ਪੈਂਦੀ ਹੈ ਤੁਸੀਂ ਆਪਣੇ ਆਪ 'ਚ ਹੀ ਇੱਕ ਪੂਰਾ ਏਜੰਸੀ ਬਣ ਜਾਂਦੇ ਹੋ ਹੈ ਨਾ ਅਤੇ ਉਹਦੇ ਵਿੱਚ ਤੁਹਾਨੂੰ ਅੱਛੀ ਇਨਕਮ ਵੀ ਆ ਜਾਂਦੀ ਹੈ ਅਤੇ ਤੁਹਾਡਾ ਅੱਛਾ ਕਾਰੋਬਾਰ ਵੀ ਚੱਲਣ ਲੱਗ ਜਾਂਦਾ ਅਤੇ ਮੈਂ ਨਹੀਂ ਸਮਝਦੀ ਕਿ ਵੱਡੀ ਪੂੰਜੀ ਦੀ ਲੋੜ ਹੈ ਅਤੇ ਕਿਉਂਕਿ ਉਹ ਕਮਿਸ਼ਨ ਬੇਸਡ ਕੰਮ ਹੁੰਦਾ ਹੈ ਅਤੇ ਉਹ ਤੁਹਾਡੀ ਤੁਹਾਨੂੰ ਆਫਿਸ ਵੀ ਕੰਪਨੀ ਪ੍ਰੋਵਾਈਡ ਕਰਦੀ ਹੈ ਸਾਰਾ ਕੁਝ ਕੰਪਨੀ ਵੱਲੋਂ ਹੀ ਹੁੰਦਾ ਹੈ ਨਾ ਅਤੇ ਬਾਕੀ ਮਤਲਬ ਅੱਛੀ ਅਰਨਿੰਗ ਕਰ ਸਕਦੇ ਆ ਤੁਸੀਂ ਬਸ